ਮੈਂ ਮਮਤਾ ਦੇਵੀ ਵਾਸੀ ਮਾਧੋਪੁਰ ਜ਼ਿਲ੍ਹਾ ਪਠਾਨਕੋਟ ਦੀ ਰਹਿਣ ਵਾਲੀ ਹਾਂ ਮੈਂ ਦਿਸ ਦੱਸ ਰਹੀ ਹਾਂ ਕਿ ਸਾਡੇ ਮਾਧੋਪੁਰ ਪੰਜਾਬ ਜੋ ਕਿ ਜੰਮੂ ਕਸ਼ਮੀਰ ਦੀ ਹੱਦਬਸਤ ਦੇ ਨਾਲ ਲੱਗਦਾ ਹੈ ਤੋ ਜੋ ਪੰਜਾਬ ਤੋਂ ਸ਼ੁਰੂ ਹੋ ਜਾਂਦਾ ਹੈ ਇੱਥੇ ਜੁਗਿਆਲ ਵਿੱਚ ਇੱਕ ਕਿਲ੍ਹਾ ਹੈ ਕਈ ਤਰ੍ਹਾਂ ਦੀਆਂ ਇਤਿਹਾਸਿਕ ਇਮਾਰਤਾਂ ਹਨ ਕਈ ਤਰ੍ਹਾਂ ਦੇ ਇਤਿਹਾਸਕ ਦ੍ਰਿਸ਼ ਦੇਖਣ ਨੂੰ ਮਿਲਦੇ ਹਨ ਜਿਸ ਤਰ੍ਹਾਂ ਇੱਥੇ ਇੱਕ ਫਿਰੋਜ਼ਪੁਰ ਕਲਾਂ ਦੇ ਕੋਲ ਬਾਗ ਵਾਲੀ ਮਾਤਾ ਹੈ ਜੋ ਕਿ ਧਾਰਮਿਕ ਸ਼ਰਧਾ ਦੇ ਨਾਲ ਲੋਕ ਉੱਥੇ ਆ ਕੇ ਮੱਥਾ ਟੇਕਦੇ ਹਨ ਲੋਕਾਂ ਦੀਆਂ ਮੁਰਾਦਾਂ ਪੂਰੀਆਂ ਹੁੰਦੀਆਂ ਹਨ ਜੇਕਰ ਮੈਂ ਇਸ ਤੋਂ ਅੱਗੇ ਦੀ ਗੱਲ ਕਰਾਂ ਤਾਂ ਸਾਡੇ ਪਠਾਨਕੋਟ ਜ਼ਿਲ੍ਹੇ ਵਿੱਚ ਬਾਠ ਸਾਹਿਬ ਜੋ ਕਿ ਸਿੱਖਾਂ ਦਾ ਬੜਾ ਹੀ ਪਵਿੱਤਰ ਗੁਰਦੁਆਰਾ ਹੈ ਉੱਥੇ ਹਰ ਧਰਮ ਦੇ ਲੋਕ ਉੱਥੇ ਜਾ ਕੇ ਬਾਬਾ ਸ਼੍ਰੀ ਚੰਦ ਜੋ ਕਿ ਗੁਰੂ ਨਾਨਕ ਦੇਵ ਜੀ ਦੇ ਬੱਚੇ ਸਨ ਉਹਨਾਂ ਦੀ ਯਾਦ ਵਿੱਚ ਬਣਾਇਆ ਗਿਆ ਹੈ ਲੋਕ ਉੱਥੇ ਇਸ਼ਨਾਨ ਕਰਕੇ ਅਤੇ ਉਹਨਾਂ ਦੀਆਂ ਉੱਥੇ ਮੱਥਾ ਟੇਕਦੇ ਹਨ ਆਪਣੀਆਂ ਮੁਰਾਦਾਂ ਉਹਨਾਂ ਦੇ ਅੱਗੇ ਰੱਖਦੇ ਹਨ ਇਸ ਤਰ੍ਹਾਂ ਕਈ ਇਤਿਹਾਸਕ ਸਥਾਨ ਜੋ ਕਿ ਸਾਡੇ ਇਲਾਕੇ ਸਾਡੇ ਪਿੰਡ ਦੇ ਨਾਲ ਸੰਬੰਧਿਤ ਹਨ ਇੱਕ ਸਾਡੇ ਕੋਲ ਹੀ ਪੰਜ ਬੜੀ ਜਗ੍ਹਾ ਹੈ ਜਿੱਥੇ ਰਾਵੀ ਦਰਿਆ ਦੇ ਕੰਡੇ ਜੁਲਾਈ ਮਹੀਨੇ ਬੜਾ ਹੀ ਭਾਰੀ ਮੇਲਾ ਲੱਗਦਾ ਹੈ ਜੇਕਰ ਅਸੀਂ ਉੱਥੇ ਜਾ ਕੇ ਪੀਰ ਬਾਬੇ ਦੇ ਆਪਣਾ ਕੋਈ ਮੁਰਾਦ ਰੱਖਦੇ ਹਾਂ ਤਾਂ ਉਹ ਪੂਰੀ ਹੋ ਜਾਂਦੀ ਹੈ ਇਸ ਤਰ੍ਹਾਂ ਸਾਡੇ ਇਲਾਕੇ ਵਿੱਚ ਕਈ ਧਾਰਮਿਕ ਅਤੇ ਇਤਿਹਾਸਿਕ ਇਹ ਜਗ੍ਹਾ ਹਨ ਜੋ ਕਿ ਖਿੱਚ ਦਾ ਕੇਂਦਰ ਹਨ ਧੰਨਵਾਦ